ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਕੀ ਤੁਸੀਂ ਰੇਲਵੇ ਵਿਭਾਗ ਤੋਂ ਗੱਲ ਕਰ ਰਹੇ ਹੋ ਸਰ ਮੈਂ ਦਿੱਲੀ ਤੋਂ ਪੂਨੇ ਤੱਕ ਦੀ ਆਨਲਾਈਨ ਟ੍ਰੇਨ ਰਜਿਸਟਰੇਸ਼ਨ ਕਰਵਾਈ ਹੈ ਮੇਰੀ ਉੱਥੇ ਬਹੁਤ ਜ਼ਰੂਰੀ ਮੀਟਿੰਗ ਹੈ ਅਤੇ ਮੇਰਾ ਉਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਸਰ ਮੈਂ ਤੁਹਾਡੇ ਤੋਂ ਇਹ ਜਾਣਣਾ ਚਾਹੁੰਦਾ ਹਾਂ ਕਿ ਇਹ ਟ੍ਰੇਨ ਆਪਣੇ ਸਹੀ ਸਮੇਂ 'ਤੇ ਹੈ ਮੇਰੀ ਟ੍ਰੇਨ ਦਾ ਸਮਾਂ ਦੁਪਹਿਰ ਦੋ ਵੱਜ ਕੇ ਪੰਦਰ੍ਹਾਂ ਮਿੰਟ ਦਾ ਹੈ ਪਲੀਜ਼ ਸਰ ਮੈਨੂੰ ਦੱਸਿਆ ਜਾਵੇ ਕਿ ਟ੍ਰੇਨ ਸਹੀ ਸਮੇਂ 'ਤੇ ਆਪਣੇ ਦਿੱਲੀ ਰੇਲਵੇ ਸਟੇਸ਼ਨ 'ਤੇ ਆਵੇਗੀ ਜੇਕਰ ਟਰੇਨ ਦਾ ਸਮਾਂ ਇਧਰ ਇਧਰ ਹੁੰਦਾ ਹੈ ਤਾਂ ਮੈਨੂੰ ਉਸ ਸਮੇਂ ਕੋਈ ਸਹੂਲਤ ਮਿਲ ਸਕਦੀ ਹੈ ਸਰ ਕਿਰਪਾ ਕਰਕੇ ਜਾਂਚ ਕਰਕੇ ਮੈਨੂੰ ਦੱਸਿਆ ਜਾਵੇ ਸਰ ਬੇਨਤੀ ਹੈ ਕਿ ਮੇਰਾ ਉੱਥੇ ਸਮੇਂ 'ਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਟਰੇਨ ਦੀ ਸਮੇਂ ਦੀ ਜਾਂਚ ਕਰਕੇ ਮੈਨੂੰ ਦੱਸਿਆ ਜਾਵੇ ਸਰ ਤੁਹਾਡੇ ਬਹੁਤ ਹੀ ਉਪਕਾਰ ਹੋਵੇਗਾ ਧੰਨਵਾਦ ਸਰ